ਮੇਰਾ ਨਾਮ ਦਰਸ਼ਨ ਕੌਰ ਹੈ ਤੁਸੀਂ ਗਗਨ ਟਰੈਵਲ ਏਜੈਂ ਟਰੈਵਲ ਤੋਂ ਗੱਲ ਕਰਦੇ ਓਂ ਅਸੀਂ ਜੀ ਮੱਥਾ ਟੇਕਣ ਜਾਣਾ ਫਤਿਹਗੜ੍ਹ ਸਾਹਿਬ ਚਾਰ ਬੰਦਿਆਂ ਦੀ ਟੈਕਸੀ ਬੁੱਕ ਕਰਨੀ ਆ ਕਿੰਨੇ ਪੈਸੇ ਤੁਸੀਂ ਲਓਂਗੇ ਜੇਕਰ ਅਸੀਂ ਦੋ ਬੰਦੇ ਵਧਾ ਕੇ ਛੇ ਬੰਦੇ ਕਰਨੇ ਹੋਣ ਤਾਂ ਸਾਨੂੰ ਕਿਹੜੀ ਟੈਕਸੀ ਸਾਨੂੰ ਠੀਕ ਰਹੇਗੀ ਸਾਨੂੰ ਦੋਨਾਂ ਦੇ ਪੈਸੇ ਦੱਸ ਦਿਓ ਜਿੰਨੇ ਪੈਸੇ ਬਣਦੇ ਆ ਸਾਨੂੰ ਵਟਸਐਪ 'ਤੇ ਸੈਂਡ ਕਰ ਦਿਓ ਬਾਕੀ ਤੁਹਾਨੂੰ ਮੈਂ ਦੱਸ ਦੇਵਾਂਗੇ ਫ਼ੋਨ ਕਰਕੇ ਬਾਕੀ ਤੁਹਾਡਾ ਬਹੁਤ ਸ਼ੁਕਰ ਗੁਜ਼ਾਰ ਹਾਂ